ਮੇਰੇ ਖੇਤਰ ਵਿੱਚ ਲੋਕ ਪ੍ਰਮੁੱਖ ਤੌਰ 'ਤੇ ਕਈ ਫੋਨ ਨੂੰ ਤਰਜੀਹ ਦਿੰਦੇ ਹਨ ਜਿਵੇਂ ਕਿ ਓਪੋ ਐਪਲ ਵੀਵੋ ਜਾਂ ਨੌਕੀਆ ਐੱਮ ਸੈਵਨ ਰੀਅਲਮੀ ਟੈਕਨੋ ਅਤੇ ਹੋਰ ਵੀ ਬਹੁਤ ਹਨ ਪਰ ਲੋਕ ਜ਼ਿਆਦਾਤਰ ਐਪਲ ਬ੍ਰੈਂਡ ਨੂੰ ਲੈਣਾ ਪਸੰਦ ਕਰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਹ ਇੱਕ ਅਡੈਂਟਿਟੀ ਸਿੰਬਲ ਹੈ ਇਸ ਤੋਂ ਇਲਾਵਾ ਵਧੀਆ ਕੁਆਲਿਟੀ ਨਹੀਂ ਹੈ ਮੇਰੇ ਕੋਲ ਵੀਵੋ ਕੰਪਨੀ ਦਾ ਫੋਨ ਹੈ ਇਸ ਵਿੱਚ ਛੇ ਜੀ ਬੀ ਰੈਮ ਅਤੇ ਇੱਕ ਸੌ ਅਠਾਈ ਜੀ ਬੀ ਸਟੋਰੇਜ ਹੈ ਇਹ ਬਹੁਤ ਵਧੀਆ ਹੈ ਮੈਂ ਇਸਨੂੰ ਇਸ ਕਰਕੇ ਵਰਤਦਾ ਹਾਂ ਕਿਉਂਕਿ ਇਸਦਾ ਫਰੰਟ ਕੈਮਰਿਆਂ ਦੀ ਕੁਆਲਿਟੀ ਬਹੁਤ ਵਧੀਆ ਹੈ ਅਤੇ ਇਹ ਉੱਪਰ ਦੀ ਓਪਨ ਹੁੰਦਾ ਹੈ ਅਤੇ ਬਹੁਤ ਸਾਫ ਹੈ ਅਤੇ ਇਸ ਵਿੱਚ ਗੇਮ ਬਹੁਤ ਸਮੂਥ ਚੱਲਦੀ ਹੈ ਇਸ ਵਿੱਚ ਮੈਂ ਪਬਜੀ ਮੋਬਾਈਲ ਗੇਮ ਖੇਡਦਾ ਹਾਂ ਅਤੇ ਹੋਰ ਵੀ ਬਹੁਤ ਸਾਰੀਆਂ ਗੇਮਾਂ ਖੇਡਦਾ ਹਾਂ ਇਹ ਹੈਂਗ ਬਿਲਕੁਲ ਨਹੀਂ ਹੁੰਦਾ ਇਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਇਸਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਹੈ ਮਿਊਜ਼ਿਕ ਸਿਸਟਮ ਬਹੁਤ ਵਧੀਆ ਹੈ ਅਤੇ ਐੱਚ ਡੀ ਕੁਆਲਿਟੀ ਜਿਸ 'ਚ ਰੇਡੀਓਜ਼ ਦੇਖ ਦੇਖਦਾ ਹਾਂ ਇਹ ਫੋਨ ਇਹ ਫੋਨ ਦੀ ਕੀਮਤ ਤੇਤੀ ਹਜ਼ਾਰ ਰੁਪਈਆ ਹੈ ਬਸ